ਹਾਂਜੀ ਜਿਹੜੇ ਗੂਗਲ ਜਾਂ ਐਮੇਜੋਨ ਦੇ ਵੋਇਸ ਕੰਟਰੋਲ ਜਿਹੜੇ ਹੋਮ ਅਸਿਸਟੈਂਟ ਹੈਗੇ ਆ ਉਹਨਾਂ ਦੀ ਵਰਤੋਂ ਕੀਤੀ ਹੈਗੀ ਹ ਤੇ ਇਹਨਾਂ ਦੇ ਦੇਖੋ ਕੁਛ ਪਲੱਸ ਪੁਆਇੰਟ ਵੀ ਹੈਗੇ ਆ ਤੇ ਕੁਛ ਨੈਗੇਟਿਵ ਪੁਆਇੰਟ ਵੀ ਹੈਗੇ ਆ ਪਲਸ ਪੁਆਇੰਟ ਇਹ ਹੈਗੇ ਆ ਕਿ ਤੁਸੀਂ ਪੈਰਲਲ ਦੇ ਵਿੱਚ ਕਈ ਸਾਰੇ ਕੰਮ ਇਕੱਠੇ ਹੈਂਡਲ ਕਰ ਸਕਦੇ ਹੋ ਵੀ ਤੁਹਾਡਾ ਟਾਈਮ ਜਿਹੜਾ ਬਿਜ਼ੀ ਹੋ ਤੁਸੀਂ ਬੈਠੇ ਬਿਠਾਏ ਆਪਣਾ ਕੋਈ ਕੰਮ ਕਰ ਰਹੇ ਹੋ ਤੁਸੀਂ ਆਰਡਰ ਦੇਣਾ ਹੈਗਾ ਕਿ ਲਾਈਟ ਜਗਾ ਦੇ ਜਾਂ ਬੰਦ ਕਰਦੇ ਜਾਂ ਕੁਛ ਉਹ ਹੋਰ ਕੋਈ ਆਪਣੀ ਪਸੰਦ ਦਾ ਕੋਈ ਗਾਣਾ ਚਲਾਣਾ ਸੌਗ ਚਲਾਣਾ ਜਾਂ ਪ੍ਰੋਗਰਾਮ ਟੀ ਵੀ ਤੇ ਚਲਾਣਾ ਤਾਂ ਉਹ ਕਰ ਸਕਦੇ ਹੋ ਇਸ ਤੋਂ ਬਿਨਾਂ ਹੋਰ ਤੁਹਾਡਾ ਥੋੜੀ ਐਫੀਸ਼ੀਅਲ ਰਿਲੇਟਡ ਤੁਸੀਂ ਜਿਵੇਂ ਕਹਿ ਦਿੰਨੇ ਹੋ ਕਿ ਮੈਨੂੰ ਇੰਨੇ ਵਜੇ ਜਗਾ ਦਵੇ ਮੇਰਾ ਅਲਾਰਮ ਲਗਾ ਦਵੀ ਜਾ ਇਹ ਚੈਨਲ ਚਲਾ ਦਵੇ ਵੀ ਤੁਹਾਡਾ ਇੱਕ ਇੱਕ ਤੁਹਾਨੂੰ ਹੈਲਪਰ ਮਿਲ ਗਿਆ ਉਹ ਤੁਹਾਡੀ ਹੈਲਪ ਕਰ ਸਕਦਾ ਲੇਕਿਨ ਜੇ ਦੂਸਰੇ ਪਾਸੇ ਦੇਖੀਏ ਤਾਂ ਥੋੜੇ ਜਿਹੇ ਪ੍ਰੋਬਲਮ ਜੀ ਹੈਗੀਆਂ ਕਈ ਵਾਰ ਠੀਕ ਕੰਮ ਨਹੀਂ ਕਰਦਾ ਕੋਈ ਨੋਇਸ ਹੁੰਦੀ ਹੈ ਜਾਂ ਕੋਈ ਫਾਲਟ ਆ ਗਿਆ ਤੁਹਾਨੂੰ ਆਦਤ ਪੈ ਗਈ ਤੀਸਰਾ ਮੈਂ ਇਹ ਵੀ ਸਮਝਦਾ ਵੀ ਸਾਡੀ ਚੱਲਣ ਫਿਰਨ ਦੀ ਉੱਠਣ ਦੀ ਜਿਹੜੀ ਸਮਰੱਥਾ ਜਾ ਤਾਕਤ ਹ ਜਾਂ ਐਕਸਰਸਾਈਜ ਜਿਹੜੀ ਹੁੰਦੀ ਸੀ ਉਹ ਬੰਦ ਹੋ ਗਈ ਹੈਗੀ ਐ ਅਸੀਂ ਬੜੇ ਆਲਸੀ ਹੋ ਗਏ ਆਂ ਸਾਨੂੰ ਇਹ ਹੈ ਕਿ ਅਸੀਂ ਬੈਡ ਤੋਂ ਜਾਂ ਸੋਫੇ ਤੋਂ ਉੱਠਣਾ ਨਾ ਪਵੇ ਕਿ ਗੂਗਲ ਤੇ ਐਮਾਜੋਨ ਜਿਹੜੇ ਵੋਇਸ ਅਸਿਸਟੈਂਟ ਕੰਟਰੋਲ ਐ ਇਹ ਸਾਡਾ ਬੈਠੇ ਬਿਠਾਏ ਕੰਮ ਕਰ ਦੇਣ ਇਸ ਨਾਲ ਸਾਡੀ ਹੈਲਥ ਤੇ ਜਿਹੜਾ ਬੁਰਾ ਪ੍ਰਭਾਵ ਪੈਂਦਾ ਤਾਂ ਇਸ ਕਰਕੇ ਇਹ ਚੀਜ਼ਾਂ ਮੈਨੂੰ ਜਿਹੜੀਆਂ ਨਹੀਂ ਪਸੰਦ ਹੈਗੀਆਂ ਕਿ ਜਿਹੜੀ ਸਾਡੀ ਫਿਜੀਕਲ ਐਕਟੀਵਿਟੀ ਨੂੰ ਇਹ ਘੱਟ ਕਰਦੀਆਂ ਇਸ ਕਰਕੇ ਇਹ ਇੱਕ ਲਿਮਿਟ ਤੱਕ ਹੀ ਇਹਦਾ ਯੂਜ ਕਰਨਾ ਚਾਹੀਦਾ ਧੰਨਵਾਦ